ਹੈਲੋ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਭਾਅ ਜੀ ਮੈਨੇ ਨਾ ਕੈਬ ਬੁੱਕ ਕੀਤੀ ਸੀ ਜੀ ਸਨੌਰ ਤੋਂ ਪਟਿਆਲੇ ਦੀ ਹਾਂਜੀ ਭਾਅ ਜੀ ਉਹਦੇ ਵਿੱਚ ਨਾ ਮੇਰਾ ਨਾ ਪਰਸ ਰਹਿ ਗਿਆ ਸੀ ਜੀ ਕੈਬ 'ਚ ਹਾਂਜੀ ਉਹਦੇ ਵਿੱਚ ਮੇਰਾ ਆਧਾਰ ਕਾਰਟ ਅਤੇ ਹੋਰ ਕੁਝ ਕਾਗਜ਼ ਕੀਮਤੀ ਸੀ ਜੀ ਹਾਂਜੀ ਭਾਅ ਜੀ ਹਾਂਜੀ ਉਹ ਮੈਨੂੰ ਬਹੁਤ ਜ਼ਰੂਰੀ ਕਾਗਜ਼ ਹੈ ਜੀ ਆਧਾਰ ਕਾਰਟ ਹੈ ਜੀ ਤੁਸੀਂ ਪਤਾ ਲਗਾ ਸਕਦੇ ਹੋ ਜੀ ਉਹ ਕਿਸ ਕੈਬ ਵਿੱਚ ਹੈ ਹਾਂਜੀ ਭਾਅ ਜੀ ਹਾਂਜੀ ਜੀ ਕਿਰਪਾ ਕਰਕੇ ਉਹ ਮੈਨੂੰ ਵਾਪਸ ਦੇ ਦਿਉ ਜੇ ਮਿਲ ਜਾਂਦਾ ਹੈ ਤਾਂ ਤੁਸੀਂ ਮੈਨੂੰ ਹਾਂਜੀ ਹਾਂਜੀ ਤੁਸੀਂ ਮੈਨੂੰ ਦੱਸ ਦਿਉ ਜੀ ਵੀ ਤੁਸੀਂ ਮੈਨੂੰ ਫ਼ੋਨ ਕਰ ਦੋਗੇ ਇਸ ਨੰਬਰ 'ਤੇ ਅਤੇ ਜਾਂ ਮੈਂ ਲੈਣ ਆਵਾਂ ਹਾਂਜੀ ਹਾਂਜੀ ਭਾਅ ਜੀ ਤੁਹਾਡਾ ਬਹੁਤ ਧੰਨਵਾਦ ਹੋਵੇਗਾ ਜੀ ਹਾਂਜੀ ਜੀ ਸਤਿ ਸ਼੍ਰੀ ਅਕਾਲ ਭਾਅ ਜੀ